ਨਹੀਂ ਮੈਂ ਇਹ ਨਹੀਂ ਸੋਚਦਾ ਕਿ ਸਾਰੇ ਵਿਦਿਆਰਥੀ ਸਕੂਲੀ ਪੜ੍ਹਾਈ ਤੋਂ ਬਾਅਦ ਅੱਗੇ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਲਈ ਅੱਗੇ ਕੋਲੇਜ ਜਾਂ ਯੂਨੀਵਰਸਿਟੀ ਤੱਕ ਜਾਂਦੇ ਹਨ ਕਈ ਵਾਰ ਉਹ ਪਰਿਵਾਰ ਅਤੇ ਝੁਮੇਲਿਆਂ ਕਰਕੇ ਫਸ ਕੇ ਉੱਥੇ ਪੜ੍ਹਾਈ ਆਪਣੀ ਛੱਡ ਦਿੰਦੇ ਹਨ ਕਈ ਵਾਰ ਜਿੰਮੇਵਾਰੀ ਹੀ ਇੱਦਾਂ ਦੀ ਪੈ ਜਾਂਦੀ ਹੈ ਜਿਸ ਕਰਕੇ ਉਹਨਾਂ ਨੂੰ ਆਪਣੀ ਪੜ੍ਹਾਈ ਛੱਡਣੀ ਪੈਂਦੀ ਹੈ ਮੇਰੇ ਅਜਿਹੇ ਕਈ ਯਾਰ ਬੇਲੀ ਦੋਸਤ ਮਿੱਤਰ ਹੈਗੇ ਨੇ ਜਿਨ੍ਹਾਂ ਨੇ ਆਪਣੀ ਪੜ੍ਹਾਈ ਸਕੂਲ ਤੋਂ ਬਾਅਦ ਪੂਰੀ ਅੱਗੇ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਆਪਣੇ ਪਰਿਵਾਰ ਦੇ ਕਾਰੋਬਾਰ ਦੇ ਵਿੱਚ ਹੀ ਜਾਣਾ ਪਿਆ ਕਈ ਵਾਰ ਮਾਂ ਪਿਓ ਵੀ ਬੱਚਿਆਂ ਨੂੰ ਸਪੋਰਟ ਨਹੀਂ ਕਰਦੇ ਅਤੇ ਉਹਨਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਨਹੀਂ ਦਿੰਦੇ ਕਈ ਵਾਰ ਆਪਣਾ ਵੀ ਇੰਟਰਸਟ ਨਾ ਹੋਣ ਕਰਕੇ ਬੱਚਾ ਪੜ੍ਹਨ ਜੋਗਾ ਨਹੀਂ ਰਹਿੰਦਾ ਉਸ ਨੂੰ ਇਹੋ ਲੱਗਦਾ ਹੈ ਕਿ ਇਹ ਪੜ੍ਹਾਈ ਮੇਰੇ ਲਈ ਨਹੀਂ ਹੈ ਮੈਂ ਆਪਣਾ ਕਾਰੋਬਾਰ ਹੀ ਕਰਾਂ ਤਾਂ ਵਧੀਆ ਹੈ ਕਾਰੋਬਾਰ ਕਰਨਾ ਚੰਗੀ ਗੱਲ ਹੈ ਪਰ ਉਸ ਨੂੰ ਪੜ੍ਹਨ ਲਈ ਕੋਲੇਜ ਵੀ ਜ਼ਰੂਰ ਜਾਣਾ ਚਾਹੀਦਾ ਹੈ ਇੱਕ ਵਾਰੀ ਕੋਲੇਜ ਦੀ ਲਾਈਫ ਦੇਖ ਕੇ ਉਹਨੂੰ ਆਉਣੀ ਚਾਹੀਦੀ ਹੈ ਕਿਉਂਕਿ ਕੋਲੇਜ ਵਿੱਚ ਸਾਨੂੰ ਬਹੁਤ ਸਾਰੀਆਂ ਚੀਜਾਂ ਸਿੱਖਣ ਨੂੰ ਮਿਲਦੀਆਂ ਹਨ ਕਈ ਤਰ੍ਹਾਂ ਦੇ ਲੋਕਾਂ ਨਾਲ ਸਾਡਾ ਵਾਹ ਪੈਂਦਾ ਹੈ ਉਹਨਾਂ ਲੋਕਾਂ ਨਾਲ ਸਾਡਾ ਬਹੁਤ ਹੀ ਵਧੀਆ ਰਿਲੇਸ਼ਨ ਵੀ ਬਣ ਸਕਦਾ ਹੈ